ਖੂਹ ਚੋਂ ਪਾਣੀ ਕੱਢਣ ਲਈ ਪੁਰਾਣਾ ਢੰਗ ਇਸਤੇਮਾਲ ਕੀਤਾ ਜਾ ਸਕਦਾ ਹੈ ਖੂਹ 'ਚੋਂ ਪਾਣੀ ਕੱਢਣ ਲਈ ਬਾਲਟੀ ਦਾ ਇਸਤੇਮਾਲ ਹੋ ਸਕਦਾ ਹੈ ਜੇਕਰ ਬਾਲਟੀ ਨਾਲ ਪਾਣੀ ਕੱਢਣਾ ਮੁਸ਼ਕਲ ਹੈ ਤਾਂ ਖੂਹ ਦੇ ਲਾਗੇ ਜੇਕਰ ਬਿਜਲੀ ਦੀ ਵਿਵਸਥਾ ਹੈ ਤਾਂ ਇਲੈਕਟਰਿਕ ਮੋਟਰ ਰਾਹੀਂ ਖੂਹ 'ਚੋਂ ਪਾਣੀ ਕੱਢਣਾ ਹੋਰ ਵੀ ਆਸਾਨ ਹੋ ਜਾਂਦਾ ਹੈ